ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਇੱਕ ਹਫਤਾ ਪਹਿਲਾਂ ਦੀ ਹੀ ਗੱਲ ਹੈ ਮੇਰੇ ਤੋਂ ਇੱਕ ਮੇਰੇ ਕਸਟਮਰ ਮੇਰੇ ਤੋਂ ਸੂਟ ਸਿਲਾਉਣਾ ਆ ਦੇਣਾ ਆ ਗਏ ਅਤੇ ਮੈਂ ਉਹਨਾਂ ਨੂੰ ਬਹੁਤ ਮਨ੍ਹਾ ਕੀਤਾ ਕਿਉਂਕਿ ਸਾਡੇ ਸੁਖਮਨੀ ਸਾਹਿਬ ਦਾ ਪਾਠ ਸੀਗਾ ਪਰ ਉਹ ਜ਼ਬਰਦਸਤੀ ਮੈਨੂੰ ਸੂਟ ਸ ਸਿਲਾਈ ਕਰਨ ਨੂੰ ਦੇਣ ਦੇ ਗਈ ਅਤੇ ਕੰਮਾਂ ਵਿੱਚ ਮੈਂ ਐਨੀ ਬਿਜ਼ੀ ਹੋ ਗਈ ਮੇਰੇ ਦਿਮਾਗ ਵਿੱਚੋਂ ਨਿਕਲ ਗਿਆ ਕਿ ਮੈਂ ਐਤਵਾਰ ਨੂੰ ਸੂਟ ਦੇਣਾ ਹੈ ਅਤੇ ਐਤਵਾਰ ਆਇਆ ਅਤੇ ਉਹ ਮੇਰੇ ਕਸਟਮਰ ਮੇਰੇ ਤੋਂ ਸੂਟ ਲੈਣ ਆ ਗਈ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਮੇਰੇ ਤਾਂ ਦਿਮਾਗ ਵਿੱਚੋਂ ਹੀ ਨਿਕਲ ਗਿਆ ਕਿ ਮੈਂ ਤੁਹਾਡਾ ਸੂਟ ਸੀਣਾ ਸੀਗਾ ਅਤੇ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਮੈਂ ਤੁਹਾਨੂੰ ਸ਼ਾਮ ਤੱਕ ਸੂਟ ਸੀ ਕੇ ਦੇ ਦੇਵਾਂਗੀ ਅਤੇ ਮੈਂ ਫਿਰ ਮੇਰੇ ਸਾਡੇ ਗੁਆਂਢੀ ਆ ਮੈਂ ਉਹਨਾਂ ਤੋਂ ਸਲਵਾਰ ਸਟਿੱਚ ਕਰਵਾਈ ਅਤੇ ਮੈਂ ਕਮੀਜ਼ ਸੀਤਾ ਕਮੀਜ਼ ਮੈਂ ਦੋ ਘੰਟੇ 'ਚ ਸੀਤਾ ਦੋ ਘੰਟੇ 'ਚ ਉਹਨਾਂ ਨੇ ਸਲਵਾਰ ਸੀਤੀ ਫਿਰ ਜਦੋਂ ਉਹ ਸ਼ਾਮ ਨੂੰ ਆਏ ਚਲੋ ਮੈਂ ਉਹਨਾਂ ਨੂੰ ਸੂਟ ਦੇ ਦਿੱਤਾ ਉਹਨਾਂ ਨੇ ਚਲੋ ਚੈੱਕ ਕਰਕੇ ਦੇਖਿਆ ਚਲੋ ਲ ਚਲੇ ਗਏ ਅਤੇ ਉਹਨਾਂ ਨੇ ਫੰਕਸ਼ਨ ਵੀ ਸੂਟ ਪਾਇਆ ਵਧੀਆ ਲੱਗਿਆ ਉਹਨਾਂ ਨੂੰ ਅਤੇ ਉਹ ਫਿਰ ਮੇਰੇ ਕੋਲ ਦੋ ਤਿੰਨ ਦਿਨ ਬਾਅਦ ਫੰਕਸ਼ਨ ਤੋਂ ਬਾਅਦ ਆਏ ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਮੇਰਾ ਸੂਟ ਬਹੁਤ ਵਧੀਆ ਸੀਤਾ ਬਹੁਤ ਵਧੀਆ ਫਿਟਿੰਗ ਆਈ ਹੈ ਅਤੇ ਉਹਨਾਂ ਨੇ ਕਿਹਾ ਕਿ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਇਹ ਸੂਟ ਕਿੱਥੋਂ ਸਿਲਾਇਆ ਹੈ ਅਤੇ ਮੈਂ ਉਹਨਾਂ ਨੂੰ ਉਹਨਾਂ ਨੇ ਦੱਸ ਮੇਰਾ ਵ ਐਡਰੈਸ ਦੇ ਦਿੱਤਾ ਅਤੇ ਮੇਰੇ ਕੋਲ਼ ਬਹੁਤ ਸਾਰਾ ਹੋਰ ਵੀ ਕੰਮ ਆ ਗਿਆ